ਜਦੋਂ ਮੈਨੂੰ ਇੱਕ ਪਸੰਦ ਆਊਗੀ ਤਾਂ ਆਨਲਾਈਨ ਮੈਂ ਜਾ ਕੇ ਸਭ ਤੋਂ ਪਹਿਲਾਂ ਉਸਦਾ ਰੰਗ ਚੈੱਕ ਕਰੂੰਗਾ ਉਸਦਾ ਰੰਗ ਚੈੱਕ ਕਰਨ ਤੋਂ ਬਾਅਦ ਜੇ ਮੈਨੂੰ ਰੰਗ ਪਸੰਦ ਆ ਗਿਆ ਤਾਂ ਮੈਂ ਉਸ ਦਾ ਸਾਈਜ ਚੈੱਕ ਕਰੂੰਗਾ ਵੀ ਸਾਈਜ ਮੇਰੇ ਆਉਂਦਾ ਵੀ ਹੈ ਜਾਂ ਨਹੀਂ ਤਾਂ ਜੋ ਇਹ ਮੇਰੇ ਆਉਣ ਤੋਂ ਬਾਅਦ ਫਿਟ ਪੂਰੀ ਫਿਟ ਆਵੇ ਧੰਨਵਾਦ ਜੀ